ਪੋਸ਼ਣ ਯੋਜਨਾ ਦਾ ਸੰਬੰਧ ਸਾਡੇ ਸਰੀਰਕ ਵਿਕਾਸ ਨਾਲ ਸੰਬੰਧ ਰੱਖਦਾ ਹੈ ਸਾਡੇ ਸਰੀਰ ਨੂੰ ਵਿਕਾਸ ਕਰਨ ਦੇ ਲਈ ਪੋਸ਼ਣ ਤੱਤਾਂ ਦਾ ਸਾਡੇ ਸਰੀਰ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ ਇਹ ਤੱਤ ਸਾਨੂੰ ਭੋਜਨ ਦੇ ਵਿੱਚੋਂ ਪ੍ਰਾਪਤ ਹੁੰਦੇ ਹਨ ਜਿਸ ਭੋਜਨ ਦੇ ਵਿੱਚ ਸੰਤੁਲਿਤ ਸੰਤੁਲਿਤ ਤੱਤ ਮੌਜੂਦ ਹੁੰਦੇ ਹਨ ਜਿਵੇਂ ਪ੍ਰੋਟੀਨ ਕਾਰਬੋਹਾਈਡਰੇਟਸ ਚਰਬੀ ਆਦਿ ਇਹ ਤੱਤਾਂ ਦੇ ਨਾਲ ਜਿਹੜਾ ਭਰਪੂਰ ਭੋਜਨ ਹੁੰਦਾ ਉਹ ਸਾਨੂੰ ਪੋਸ਼ਣ ਦਿੰਦਾ ਹੈ ਜਿਹਦੇ ਨਾਲ ਸਾਡਾ ਜਿਹੜਾ ਸਰੀਰ ਹੈ ਉਹ ਤੰਦਰੁਸਤ ਰਹਿੰਦਾ ਹੈ ਅਤੇ ਸਾਨੂੰ ਕਈ ਤਰ੍ਹਾਂ ਦੇ ਜਿਹੜੇ ਵਿਟਾਮਿਨਸ ਨੇ ਉਹ ਵੀ ਲੈਣੇ ਚਾਹੀਦੇ ਹਨ ਜਿਹਦੇ ਨਾਲ ਸਾਡਾ ਜਿਹੜਾ ਸਰੀਰ ਆ ਉਹ ਸਹੀ ਢੰਗ ਦੇ ਨਾਲ ਕੰਮ ਕਰਦਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਪੋਸ਼ਣ ਯੋਜਨਾ ਪੋਸ਼ਣ ਯੋਜਨਾ ਦੇ ਵਿੱਚ ਭਾਰਤ ਸਰਕਾਰ ਦੁਆਰਾ ਇਹ ਜਿਹੜੀ ਚੀਜ਼ ਆ ਉਹ ਇਸ ਦੀ ਗਰੰਟੀ ਦਿੱਤੀ ਗਈ ਵੀ ਹਰੇਕ ਨਾਗਰਿਕ ਨੂੰ ਉਸ ਦੀ ਇਹ ਸਰੀਰ ਦੇ ਅਨੁਸਾਰ ਜਿੰਨੀ ਉਸਨੂੰ ਕੈਲੋਰੀ ਦੀ ਲੋੜ ਹੈ ਉਹ ਕੈਲਰੀ ਮੁਹੱਈਆ ਕਰਵਾਈ ਜਾਵੇ ਚਾਹੇ ਉਹ ਬੱਚਾ ਹੈ ਚਾਹੇ ਉਹ ਕੋਈ ਅਠਾਰ੍ਹਾਂ ਸਾਲ ਤੋਂ ਵੱਧ ਉਮਰ ਵਾਲਾ ਵਿਅਕਤੀ ਹੈ ਉਸ ਦਾ ਸਰੀਰਕ ਵਿਕਾਸ ਕਰਨ ਦੇ ਲਈ ਉਸਨੂੰ ਲੋੜੀਂਦਾ ਜਿਹੜਾ ਭੋਜਨ ਆ ਉਹ ਮੁਹੱਈਆ ਕਰਵਾਇਆ ਜਾਵੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਸਰਕਾਰਾਂ ਨੇ ਉਹ ਨਾਗਰਿਕਾਂ ਦੇ ਸਰੀਰਕ ਵਿਕਾਸ ਪ੍ਰਤੀ ਸੁਚੇਤ ਹੋਣਗੀਆਂ ਤਾਂ ਅੱਜ ਅਸੀਂ ਦੇਖਦੇ ਹਾਂ ਵੀ ਕਈ ਪ੍ਰਕਾਰ ਦੀਆਂ ਸਕੀਮਾਂ ਨੇ ਉਹ ਚਲਾਈਆਂ ਜਾਂਦੀਆਂ ਨੇਗੀਆਂ ਜਿਵੇਂ ਘਰ ਘਰ ਰਾਸ਼ਨ ਯੋਜਨਾ ਹੋ ਗਈ ਬੱਚਿਆਂ ਦੇ ਲਈ ਆਂਗਣਵਾੜੀ ਦੇ ਵਿੱਚ ਵੱਖ ਵੱਖ ਸਹੂਲਤਾਂ ਹੋ ਗਈਆਂ ਤਾਂ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇਗੀਆਂ ਇਹ ਸਾਰੇ ਨਾਗਰਿਕਾਂ ਦੇ ਲਈ ਸਮਾਨ ਰੂਪ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿਹਦੇ ਨਾਲ ਸਾਡਾ ਸਾਰੇ ਨਾਗਰਿਕਾਂ ਦਾ ਜਿਹੜਾ ਸਰੀਰਕ ਵਿਕਾਸ ਆ ਉਹ ਜੁੜਿਆ ਹੁੰਦਾ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਹਰੇਕ ਵਿਅਕਤੀ ਨੂੰ ਆਪਣਾ ਰੋਜ਼ਾਨਾ ਜੀਵਨ ਬਤੀਤ ਕਰਨ ਦੇ ਲਈ ਦੋ ਹਜ਼ਾਰ ਤੋਂ ਤਿੰਨ ਹਜ਼ਾਰ ਤੱਕ ਜਿਹੜੀ ਕੈਲਰੀ ਆ ਉਹ ਲੋੜੀਂਦੀ ਹੈ ਜਿਹਦੇ ਨਾਲ ਉਹ ਆਪਣੇ ਸਾਰੇ ਰੋਜ਼ਾਨਾ ਦੇ ਜਿਹੜੇ ਕੰਮ ਆ ਉਹ ਕਰ ਸਕਦਾ ਹੈ ਅਤੇ ਇੱਕ ਵਿਅਕਤੀ ਦੇ ਉੱਤੇ ਇਹ ਸਾਰੇ ਪਰਿਵਾਰ ਦੀ ਜਿਹੜੀ ਕੀ ਆ ਉਹ ਜ਼ਿੰਮੇਵਾਰੀ ਹੁੰਦੀ ਹੈ ਤਾਂ ਇਸ ਤਰੀਕੇ ਦੇ ਨਾਲ ਜੇਕਰ ਸਾਡੇ ਨਾਗਰਿਕ ਸਹੀ ਢੰਗ ਦੇ ਨਾਲ ਭੋਜਨ ਲੈਣਗੇ ਤਾਂ ਉਹ ਆਪਣੇ ਪਰਿਵਾਰ ਦੇ ਲਈ ਅਤੇ ਆਪਣੇ ਦੇਸ਼ ਦੇ ਲਈ ਵੱਖ ਵੱਖ ਤਰੀਕਿਆਂ ਦੇ ਨਾਲ ਯੋਗਦਾਨ ਪਾ ਸਕਦੇ ਹਨ ਤਾਂ ਇਸ ਤਰਾਂ ਜਿਹੜੀਆਂ ਸਰਕਾਰਾਂ ਨੇ ਉਹ ਸਾਡੇ ਨਾਗਰਿਕਾਂ ਦੇ ਸਰੀਰਿਕ ਵਿਕਾਸ ਲਈ ਪਾਬੰਦ ਹਨ